ਮੇਰੇ ਖੇਤਰ ਦੇ ਵਿੱਚ ਖੇਡਾਂ ਆਉਂਦੀਆਂ ਨੇ ਲੋਕਾਂ ਨੂੰ ਆਪਣੇ ਸੁਪਨਿਆਂ ਲਈ ਖੇਡਾਂ ਖੇਡਣ ਲਈ ਬੜੀਆਂ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਵੇਂ ਤੇ ਗਰਾਊਂਡ ਵੀ ਨਹੀਂ ਹੁੰਦਾ ਕੋਚ ਨਹੀਂ ਇੰਨੀ ਛੇਤੀ ਮਿਲਦੇ ਹੈਗੇ ਅਗਰ ਮਿਲਣਗੇ ਤਾਂ ਬਹੁਤ ਮਹਿੰਗੇ ਹੋਣਗੇ ਲੋਕ ਅਫੋਰਡ ਹੀ ਨਹੀਂ ਕਰ ਪਾਉਂਦੇ ਉਂਤੇ ਸਿੱਖਣ ਲਈ ਦੂਜੇ ਦੂਰ ਜਾਣਾ ਪੈਂਦਾ ਪਿੰਡ ਤੋਂ ਦੂਰ ਸ਼ਹਿਰ ਦੇ ਵਿੱਚ ਜਾਣਾ ਪੈਂਦਾ ਫਿਰ ਉੱਥੇ ਸਿੱਖਣ ਲਈ ਥੋੜ੍ਹਾ ਮੁਸ਼ਕਿਲ ਹੁੰਦਾ ਔਖਾ ਲੱਗਦਾ ਪੈਸੇ ਵੀ ਜ਼ਿਆਦਾ ਲੱਗਦੇ ਨੇ ਅਤੇ ਇੱਕ ਅਦ ਜਿਹੜੇ ਨੂੰ ਕੋਚ ਸਿਖਾਉਂਦਾ ਵੀ ਨਹੀਂ ਨੇ ਉਹਨਾਂ ਨੂੰ ਜ਼ਿਆਦਾ ਜਣੇ ਹੋਣ ਤਾਂ ਉਹ ਸਿਖਾਉਂਦੇ ਨੇ ਅਤੇ ਜੇ ਅਗਰ ਇੱਕ ਜਣੇ ਨੂੰ ਸਿਖਾਉਣਾ ਤਾਂ ਫਿਰ ਉਹਦੀ ਫੀਸ ਬਹੁਤ ਜ਼ਿਆਦਾ ਹੁੰਦੀ ਹੈ